ਹਾਂ ਮੈਂ ਕਈ ਵਾਰ ਟੀਵੀ 'ਤੇ ਖਬਰਾਂ ਵਿੱਚ ਬਹਿਸ ਦੇਖੀ ਹੈ ਜੋ ਕਿ ਨਿਊਜ ਐਕ ਸਰ ਦੁਆਰਾ ਅਤੇ ਉਹਨਾਂ ਵਿੱਚ ਕਈ ਸ ਲੋਕਾਂ ਦੁਆਰਾ ਕੀਤੀ ਜਾਂਦੀ ਹੈ ਜੋ ਕਿ ਕਈ ਗੱਲਾਂ ਵਿੱਚ ਸਹੀ ਵੀ ਹੁੰਦੇ ਹਨ ਅਤੇ ਕਈਆਂ ਵਿੱਚ ਗਲਤ ਵੀ ਹੁੰਦੇ ਹਨ ਟੀਵੀ ਨਿਊਜ ਵਾਲੇ ਤਾਂ ਵੈਸੇ ਵੀ ਹਰ ਗੱਲ ਨੂੰ ਵਧਾਅ ਚੜ੍ਹਾਅ ਕੇ ਹੀ ਦੱਸਦੇ ਹਾਂ ਹਨ ਅਤੇ ਕਈ ਸਾਰੀਆਂ ਗੱਲਾਂ ਤਾਂ ਬਿਨਾਂ ਮਤਲਬ ਤੋਂ ਹੀ ਬਹਿਸ ਕਰਦੇ ਹਨ ਕਈ ਵਾਰ ਉਹਨਾਂ ਦੀ ਬਹਿਸ ਬਿਲਕੁਲ ਠ ਸਹੀ ਹੁੰਦੀ ਹੈ ਜੋ ਕਿ ਲੋਕਾਂ ਦੇ ਹਿੱਤ ਵਿੱਚ ਹੁੰਦੀ ਹੈ ਪਰ ਕਈ ਵਾਰ ਉਹਨਾਂ ਦੀ ਬਹਿਸ ਗਲਤ ਸਥਾਨ 'ਤੇ ਹੁੰਦੀ ਗਲਤ ਜਗ੍ਹਾ 'ਤੇ ਗਲਤ ਹੀ ਇਰਾਦਿਆਂ ਨਾਲ ਹੁੰਦੀ ਹੈ ਜਿਸ ਨਾਲ ਲੋਕਾਂ ਦਾ ਬਹੁਤ ਹੀ ਨੁਕਸਾਨ ਹੋ ਸਕਦਾ ਹੈ ਲੋਕਾਂ ਨੂੰ ਨੂੰ ਮੀਡੀਆ ਦੁਆਰਾ ਟੀਵੀ 'ਤੇ ਵਧੀਆ ਵਿਚਾਰਾਂ ਵਿਚਾਰਧਾਰਾ ਦੇਣੀ ਚਾਹੀਦੀ ਹੈ ਜਿਸ ਨਾਲ ਕਿ ਲੋਕ ਆਪਣੇ ਆਪ ਨੂੰ ਸੁਰੱਕਸ਼ਿਤ ਮਹਿਸੂਸ ਕਰਨ ਪਰ ਕਈ ਵਾਰ ਤਾਂ ਉਹ ਬਹਿਸ ਲੜਾਈ ਵਿੱਚ ਬਦਲ ਜਾਂਦੀ ਹੈ ਜੋ ਕਿ ਬਹੁਤ ਹੀ ਮਾੜਾ ਪ੍ਰਭਾਵ ਪਾਉਂਦੀ ਹੈ ਹੈ ਕਈ ਵਾਰ ਤਾਂ ਉਹ ਬਹਿਸ ਵਿੱਚ ਕਈ ਬੰਦਿਆਂ ਨੂੰ ਚੋਟ ਵੀ ਆ ਜਾਂਦੀ ਹੈ ਜਿਵੇਂ ਕਈ ਵਾਰ ਤਾਂ ਉਹਨਾਂ ਦਾ ਮਾਲ ਤਾਲ ਜਾਨ ਮਾਲ ਦਾ ਵੀ ਕਾਫ਼ੀ ਨੁਕਸਾਨ ਹੋ ਜਾਂਦਾ ਹੈ ਜੋ ਕਿ ਬਹੁਤ ਹੀ ਮਾੜੀ ਗੱਲ ਹੈ ਟੀਵੀ ਖਬਰਾਂ ਵਿੱਚ ਬਹਿਸ ਹੋਣੀ ਵੀ ਚਾਹੀਦੀ ਹੈ ਕਈ ਮਾਮਲਿਆਂ ਵਿੱਚ ਇਹ ਸੱਚ ਵੀ ਹੁੰਦੇ ਹਨ